ਧਾਰਮਿਕ ਅਤੇ ਇਤਿਹਾਸਿਕ ਸਥਾਨ ਮੇਰੀਆਂ ਮਨਪਸੰਦ ਥਾਵਾਂ ਵਿੱਚੋਂ ਘੁੰਮਣ ਲਈ ਮਨਪਸੰਦ ਥਾਵਾਂ ਵਿੱਚੋਂ ਸਭ ਤੋਂ ਉਤਲੇ ਪੱਧਰ 'ਤੇ ਹਨ ਇੱਥ ਇੱਥੇ ਜਾ ਕੇ ਮੈਨੂ ਮੈਂ ਕਾਫ਼ੀ ਉਤਸ਼ਾਹਿਤ ਹੁੰਦਾ ਹਾਂ ਅਤੇ ਇੱਥੇ ਜਾਣ ਤੋਂ ਬਾਅਦ ਮੇਰੇ ਕੰਮ ਕਰਨ ਦੀ ਸਮਰੱਥਾ ਵੀ ਵੱਧਦੀ ਹੈ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਜਾ ਕੇ ਕਾਫ਼ੀ ਚੀਜ਼ਾਂ ਦਾ ਜੋ ਮੇਰੀ ਜ਼ਿੰਦਗੀ ਦੇ ਉਤਾਰ ਚੜਾਅ ਹਨ ਇੱਥੇ ਆ ਕੇ ਮੈਂ ਉਨ੍ਹਾਂ ਨੂੰ ਸ਼ਾਤ ਕਰਦਾ ਇਸ ਤੋਂ ਇਲਾਵਾ ਮੈਨੂੰ ਸ਼ਾਪਿੰਗ ਮੋਲਾਂ ਦੇ ਵਿੱਚ ਘੁੰਮਣ ਜਾਣਾ ਅਤੇ ਉੱਥੇ ਸਮਾਂ ਬਤੀਤ ਕਰਨਾ ਵਧੀਆ ਲੱਗਦਾ ਹੈ ਮੋਲ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਹੁੰਦੀਆਂ ਹਨ ਅਤੇ ਮੈਨੂੰ ਉੱਥੇ ਇਹ ਖੇਡਾਂ ਖੇਡਣੀਆਂ ਵਧੀਆ ਲੱਗਦੀਆਂ ਹਨ ਇਹਨਾਂ ਵਿੱਚੋਂ ਬਾਲਿੰਗ ਮੇਰੀ ਮਨਪਸੰਦ ਖੇਡ ਹੈ ਮੈਂ ਇਹ ਖੇਡ ਖੇਡ ਕੇ ਮੇਰੇ ਮਨ ਨੂੰ ਕਾਫ਼ੀ ਸਕੂਨ ਮਿਲਦਾ ਹੈ ਮੈਂ ਆਪਣਾ ਫਾਲਤੂ ਦਾ ਸਮਾਂ ਜਿਵੇਂ ਛੁੱਟੀ ਵਾਲਾ ਦਿਨ ਹੋਵੇ ਜਾਂ ਸ਼ਾਮ ਦਾ ਜਾਂ ਰਾਤ ਦਾ ਦਿਨ ਰਾਤ ਦਾ ਸਮਾਂ ਹੋਵੇ ਮੈਂ ਮੋਲ ਵਿੱਚ ਜਾ ਕੇ ਇਹ ਗੇਮਿੰਗ ਦੀ ਗੇਮ ਖੇਡਦਾ ਹਾਂ